ਪੰਜ ਮਾਰਚ ਉੱਨੀ ਵੀਹ ਛੇ ਜਨਵਰੀ ਅਠਾਰਾਂ ਪੰਝੱਤਰ ਸੱਤ ਫਰਵਰੀ ਵੀਹ ਇੱਕੀ ਸੋਲ੍ਹਾਂ ਮਈ ਅਠਾਰਾਂ ਚਾਲੀ ਉੱਨੀ ਦਸੰਬਰ ਪੰਦਰਾਂ ਚਾਲੀ